ਸਤਿ ਸ਼੍ਰੀ ਅਕਾਲ ਜੀ ਮੈਂ ਬਾਵਿਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਵੇਂ ਕਿ ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸਿਆ ਸੀ ਕਿ ਮੈਨੂੰ ਕੱਪੜੇ ਸਿਊਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਤੁਹਾਨੂੰ ਇੱਕ ਮਹੱਤਵਪੂਰਨ ਸੂਚਨਾ ਦੇਣਾ ਚਾਹੁੰਦੀ ਹਾਂ ਕਿ ਰੈਡੀਮੇਡ ਕੱਪੜੇ ਅਤੇ ਹੋਮਮੇਡ ਕੱਪੜੇ ਵਿੱਚ ਕੀ ਫਰਕ ਹੈ ਰੇਡੀਮੇਡ ਕੱਪੜੇ ਨਾਲੋਂ ਹੋਮਮੇਡ ਕੱਪੜੇ ਜ਼ਿਆਦਾ ਵਧੀਆਂ ਹੁੰਦੇ ਹਨ ਰੇਡੀਮੇਡ ਕੱਪੜੇ ਦਾ ਕਈ ਵਾਰੀ ਤਾਂ ਸਾਈਜ਼ ਹੀ ਫਿੱਟ ਨਹੀਂ ਆਉਂਦਾ ਜੇ ਉਸਦੀ ਫੀਟਿੰਗ ਕਰਾਓ ਤਾਂ ਉਸਦਾ ਕੱਪੜਾ ਖਰਾਬ ਹੋ ਜਾਂਦਾ ਹੈ ਕਈ ਵਾਰੀ ਤਾਂ ਕੱਪੜੇ ਦਾ ਰੰਗ ਨਿਕਲ ਜਾਂਦਾ ਹੈ ਨਿਕਲ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦੇਵਾਂਗੀ ਕਿ ਸਾਨੂੰ ਰੇਡੀਮੇਡ ਕੱਪੜੇ ਨਾਲੋਂ ਹੈਂਡਮੇਡ ਕੱਪੜੇ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਜੋ ਕਿ ਅਸੀਂ ਆਪਣੀ ਫੀਟਿੰਗ ਦੇ ਹਿਸਾਬ ਨਾਲ ਬਣਾ ਸਕਦੇ ਹਾਂ ਨਾ ਹੀ ਉਹ ਚੁਭਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਰੰਗ ਨਿਕਲਦਾ ਹੈ ਇਸ ਲਈ ਮੈਨੂੰ ਰੇਡੀਮੇਟ ਕੱਪੜੇ ਨਾਲੋਂ ਹੋਮਮੇਡ ਕੱਪੜੇ ਜ਼ਿਆਦਾ ਚੰਗੇ ਲੱਗਦੇ ਹਨ ਧੰਨਵਾਦ